ਘਰ ਵਿੱਚ ਖਾਣਾ ਬਣਾਉਣ ਸਮੇਂ ਸਾਨੂੰ ਐਲ ਪੀ ਜੀ ਸਿਲੰਡਰ ਦੀ ਵਰਤੋਂ ਕਰਦੇ ਸਮੇਂ ਪੰਜ ਛੇ ਬੇਸਿਕ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਗੈਸ ਦੀ ਪਾਈਪ ਬਿਲਕੁਲ ਠੀਕ ਹੋਣੀ ਚਾਹੀਦੀ ਹੈ ਉਹਦੇ ਵਿੱਚ ਕਿਤੇ ਵੀ ਲੀਕੇਜ ਨਹੀਂ ਹੋਣੀ ਚਾਹੀਦੀ ਦੂਸਰਾ ਜਦੋਂ ਵੀ ਅਸੀਂ ਸਲੰਡਰ ਸਾਡਾ ਖ਼ਤਮ ਹੁੰਦਾ ਆਹ ਨਵਾਂ ਸਲੰਡਰ ਅਸੀਂ ਚੇਂਜ ਕਰਨਾ ਸਾਡਾ ਰੈਗੂਲੇਟਰ ਦੇ ਵਿੱਚ ਕਿਤੇ ਵੀ ਵਾਸ਼ਰ ਉਹਦੀ ਲੀਕ ਨਾ ਹੋਵੇ ਜਿੱਥੋਂ ਕਿ ਗੈਸ ਦੀ ਸਮੈਲ ਨਾ ਆਵੇ ਗੈਸ ਦੀ ਸਮੈਲ ਆਉਣ ਦਾ ਮਤਲਬ ਹੈ ਕਿ ਸਾਡੀ ਜੇ ਕਿਤੇ ਆ ਰਹੀ ਹੈ ਤਾਂ ਉਸਦਾ ਮਤਲਬ ਹੈ ਕਿ ਸਾਡੇ ਕਿਤੇ ਨਾ ਕਿਤੇ ਪਾਈਪ 'ਚ ਜਾਂ ਰੈਗੂਲੇਟਰ 'ਚ ਜਾਂ ਸਲਿੰਡਰ ਦੀ ਵਾਸ਼ਲ ਦੇ ਵਿੱਚ ਲੀਕੇਜ ਹੈ ਜੋ ਕਿ ਸਾਨੂੰ ਤੁਰੰਤ ਬਦਲ ਦੇਣੀ ਚਾਹੀਦੀ ਹੈ ਔਰ ਉਸ ਤੋਂ ਬਾਅਦ ਸਾਨੂੰ ਸੁਰੱਖਿਆ ਨਿਯਮਾਂ ਨੂੰ ਧਿਆਨ ਚ ਰੱਖਦੇ ਹੋਏ ਫਿਰ ਹੀ ਗੈਸ ਦਾ ਉਪਯੋਗ ਕਰਨਾ ਚਾਹੀਦਾ ਹੈ ਇਸ ਲਈ ਸਾਨੂੰ ਹਮੇਸ਼ਾ ਗੈਸ ਚਲਾਉਣ ਤੋਂ ਪਹਿਲਾਂ ਧਿਆਨ ਰੱਖਣਾ ਚਾਹੀਦਾ ਕਿ ਕਿਤੇ ਐਲ ਪੀ ਜੀ ਗੈਸ ਦੀ ਸਮੈਲ ਤਾਂ ਨਹੀਂ ਆ ਰਹੀ ਜੇ ਸਮੈਲ ਨਹੀਂ ਆ ਰਹੀ ਫਿਰ ਹੀ ਉਹਨੂੰ ਯੂਜ ਕਰਨਾ ਚਾਹੀਦਾ ਅਤੇ ਉਹਨੂੰ ਯੂਜ ਕਰਨ ਤੋਂ ਬਾਅਦ ਆਰਾਮ ਨਾਲ ਬੰਦ ਕਰ ਦੇਣਾ ਚਾਹੀਦਾ ਅਤੇ ਬੰਦ ਕਰਦੇ ਹੋਏ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਗੈਸ ਦੇ ਰੈਗੂਲੇਟਰ ਜਾਂ ਨੌਬਸ ਅਤੇ ਚੁੱਲੇ ਦੀਆਂ ਨੌਬਸ ਚੰਗੀ ਤਰ੍ਹਾਂ ਬੰਦ ਹੋ ਗਈਆਂ ਹਨ ਕਿ ਨਹੀਂ ਇਹਨਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ